ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਾਡਾ ਮੇਰਾ ਵਿਆਹ ਹੈ ਜੀ ਅਤੇ ਆਪਾਂ ਟੂਮਾ ਬਣਨੀਆਂ ਦੇਣੀਆਂ ਮੈਂ ਆਪਦੇ ਲਈ ਇੱਕ ਇੱਕ ਤਾਂ ਕਿੱਟੀ ਸੈੱਟ ਦੇਣਾ ਬਣਨਾ ਮੈਂ ਆਪਦਾ ਜੀ ਅਤੇ ਇੱਕ ਮਤਲਬ ਰਿੰਗ ਦੇਣੀ ਬਣਨੀ ਅਤੇ ਮਤਲਬ ਹੱਥਾਂ ਵਾਸਤੇ ਚੂੜੀਆਂ ਗਜਰੇ ਠੀਕ ਹੈ ਜੀ ਅਤੇ ਇੱਕ ਵੰਗਾਂ ਤੁਸੀਂ ਤੋਲੇ ਦੀਆਂ ਤਾਂ ਬਣਵਾਓਗੇ ਨਾ ਇੱਕ ਤੋਲੇ ਦੀ ਠੀਕ ਹੈ ਅਤੇ ਹਾਂਜੀ ਹਾਂਜੀ ਮੈਂ ਇੱਕ ਮਤਲਬ ਹਾਂ ਜੀ ਦੋ ਬਣਵਾਵਾਂਗੇ ਜੀ ਹਾਂ ਅਤੇ ਸ਼ਿੰਗਾਰ ਪੱਟੀ ਇੱਕ ਮੈਂ ਬਣਵਾਉਣੀ ਆਂ ਉਹ ਅਕਸਰ ਦੋ ਤੋਲੇ ਤਾਂ ਚਾਹੀਦਾ ਨਾ ਹਾਂ ਹਾਂਜੀ ਹਾਂ ਹਾਂਜੀ ਇਹ ਇੱਕ ਹਾਰ ਹੋ ਜੇ ਹੋ ਗਿਆ ਇੱਕ ਮਤਲਬ ਚੂੜੀਆਂ ਹੋਈਆਂ ਇੱਕ ਰਿੰਗ ਹੋ ਗਈ ਅਤੇ ਇੱਕ ਆਪਾਂ ਮਤਲਬ ਜਿਹੜੀਆਂ ਆਪਾਂ ਅਗਲੇ ਘਰੇ ਵੀ ਮੈਂ ਜੀ ਪਾਉਣੀ ਆ ਨਾ ਹਾਂਜੀ ਅਤੇ ਵਧੀਆ ਪੰਜ ਪੰਜ ਛੇ ਛੇ ਮੱਸੇ ਦੀ ਤਾਂ ਚਾਹੀਦੀ ਹੈ ਨਾ ਹਾਂਜੀ ਹਾਂਜੀ ਅਸੀਂ ਅੱਗੇ ਵੀ ਤੁਹਾਡੀ ਬਣਵਾਉਣੇ ਹਾਂ ਜੀ ਟੁਮਾ ਅਸੀਂ ਕਿਹੜਾ ਪਹਿਲੀ ਵਾਰ ਆਏ ਹਾਂ ਨਹੀਂ ਬਾਕਮਾਲ ਬਣਵਾਵਾਂਗੇ ਜੀ ਹਾਂਜੀ ਕੋਈ ਗੱਲ ਕੋਈ ਗੱਲ ਨਹੀਂ ਮਹਿੰਗੇ ਵੀ ਆਪਾਂ ਨੂੰ ਕੋਈ ਨਹੀਂ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਕਰਵਾਉਂਦੇ ਅਸੀਂ ਨਾਲੇ ਤੁਹਾਡੇ ਤੋਂ ਕਿਹੜਾ ਅਸੀਂ ਪਹਿਲੀ ਵਾਰ ਆਏ ਹਾਂ ਅਸੀਂ ਤੁਹਾਡੇ ਤੋਂ ਅੱਗੇ ਵੀ ਸੋਨਾ ਕਰਵਾਉਂਦੇ ਹਾਂ ਅੱਗੇ ਵੀ ਦਵਾਈ ਹੁਣ ਵੀ ਮੈਂ ਆਖਿਆ ਮੈਂ ਉਥੋਂ ਜਾਣਾ ਮੈਂ ਮੈਂ ਆਪਦੀ ਮੈਂ ਕਿਹਾ ਸਾਰੀ ਉਥੋਂ ਨੂੰ ਉੱਥੋਂ ਬਈ ਬਣਵਾਉਣਾ ਮੈਂ ਆਪਦਾ ਸੈੱਟ ਵਿਖਾ ਦਿਓ ਫਿਰ ਮੈਨੂੰ ਮੈਂ ਪਸੰਦ ਕਰ ਲਵਾਂ ਹੈ ਤਿਆਰ ਨੇ ਹਾਂਜੀ ਦਿਖਾ ਦਿਓ ਫਿਰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਅੱਛਾ ਗਜਰੇ ਵੀ ਹੈਗੀ ਤੁਹਾਡੇ ਕੋਲੇ ਹੈਂ ਠੀਕ ਹੈ ਮੈਂ ਇਹ ਠੀਕ ਆ ਜੀ ਅੱਛਾ ਠੀਕ ਹੈ ਮੈਂ ਮੈਂ ਪਸੰਦ ਕਰ ਲਈ ਸੀ ਕਰਦੀ ਪਈ ਹਾਂ ਤੁਹਾਨੂੰ ਫਿਰ ਦੱਸ ਦਿੰਦੀ ਆ ਹੈ ਠੀਕ ਆ ਜੀ ਮੇਰੀ ਪਸੰਦ ਆ ਜੀ ਜੀਜੇ ਵਾਸਤੇ ਕੜਾ ਹਾਂਜੀ ਅਤੇ ਵਿਚੋਲੇ ਵਾਸਤੇ ਵਿਚੋਲੇ ਵਾਸਤੇ ਮੁੰਦੀ ਜੀ ਆਪਦੇ ਜੀਜੇ ਵਾਸਤੇ ਕੜਾ ਜੀ ਅਤੇ ਪਰਾਹੁਣੇ ਮੇਰੇ ਵਾਸਤੇ ਚੈਨੀ ਹਾਂਜੀ ਹਾਂਜੀ ਠੀਕ ਆ ਜੀ ਹਾਂ ਠੀਕ ਤਿਆਰ ਜਦੋਂ ਹਾਂਜੀ ਸਾਨੂੰ ਦੋ ਮਹੀਨੇ ਨੂੰ ਚਾਹੀਦਾ ਜੀ ਹੈ ਹਾਂਜੀ ਜੀ ਰਾ ਰੇਟ ਮਤਲਬ ਬਾਅਦ ਵਿੱਚ ਆਪਾਂ ਲਗਵਾ ਲਵਾਂਗੇ ਜੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਅਤੇ ਆਪਾਂ ਕਰ ਲਵਾਂਗੇ ਕੰਮ ਨਹੀਂ ਨਹੀਂ ਤੁਸੀਂ ਐਂਉਂ ਕਰੋ ਮੈਨੂੰ ਚੈਨੀਆਂ ਵੀ ਦਿਖਾਓ ਮੈਨੂੰ ਜਿਹੜੀ ਪਰਾਹੁਣੇ ਨੂੰ ਆਪਾਂ ਚੈਨੀ ਪਾਉਣੀ ਉਹ ਵੀ ਦਿਖਾਓ ਐਂਉਂ ਕਰੋ ਨਾ ਮੇਰੇ ਪਰਾਹੁਣੇ ਨੂੰ ਪਾਉਣੀ ਆ ਭਾਰੀ ਭਾਰੀ ਦਿਖਾਓ ਜੀ ਹਾਂਜੀ ਅੱਛਾ ਜੀ ਅੱਛਾ ਠੀਕ ਹੈ ਹਾਂ ਚੈਨੀ ਸੋਹਣੀ ਹੈ ਜੀ ਠੀਕ ਆ ਆਪਾਂ ਨੂੰ ਆਹ ਡਿਜ਼ਾਇਨ ਵਾਲੀ ਚਾਹੀਦੀ ਹੈ ਹਾਂਜੀ ਹਾਂਜੀ ਠੀਕ ਆ ਜੀ

ਹਾਂ ਹਾਂ ਠੀਕ ਹੈ ਜੀ ਹਾਂਜੀ ਚਲੋ ਠੀਕ ਧੰਨਵਾਦ ਜੀ